ਸਮਾਂ ਮਿਲਣ 'ਤੇ ਇੰਡੀਅਨ ਆਈਡਲ ਵਰਗੇ ਰਿਐਲਟੀ ਪ੍ਰੋਗਰਾਮ ਦੇਖੇ ਜਾਂਦੇ ਹਨ ਇਹਨਾਂ ਦੇ ਵਿੱਚ ਹਰੇਕ ਜੋ ਭਾਗੀਦਾਰੀ ਹੈ ਆਪਣੀ ਵਧੀਆ ਭੂਮਿਕਾ ਨਿਭਾਉਂਦਾ ਹੈ ਆਪਣੇ ਵੱਲੋਂ ਉਹ ਸੰਗੀਤ ਦੀ ਸਿੱਖਿਆ ਲੈ ਕੇ ਇਸ ਵਿੱਚ ਭਾਗ ਲੈਂਦੇ ਹਨ ਅਤੇ ਪੁਰਜ਼ੋਰ ਮਿਹਨਤ ਕਰਕੇ ਆਪਣੇ ਆਪ ਨੂੰ ਅੱਗੇ ਵਧਾਉਂਦੇ ਹਨ ਇਸ ਕੜੀ ਦੇ ਵਿੱਚ ਰਿਸ਼ੀ ਸਿੰਘ ਫੇਵਰੇਟ ਮਨਪਸੰਦ ਭਾਗੀਦਾਰ ਹੈ ਕਿਉਂਕਿ ਉਸ ਦੀ ਗਾਇਕੀ ਬਹੁਤ ਹੀ ਪਾਏਦਾਨ ਵਾਲ਼ੀ ਹੈ